ਹਾਂ ਮੈਂ ਪਹਿਲੇ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ ਸੀ ਮੈਨੂੰ ਕਾਫੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਥੋੜਾ ਬਹੁਤ ਤੁਰਨ ਤੇ ਹੀ ਸਾਹ ਚੜ ਜਾਂਦਾ ਸੀ ਪਰ ਮੈਨੂੰ ਫਿਰ ਕਿਸੇ ਮੇਰੀ ਸਹੇਲੀ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਭੰਗੜਾ ਔਰ ਐਰੋਬੈਕਸ ਜੁਆਇਨ ਕਰ ਤਾਂ ਤੇਰੀ ਸਿਹਤ ਠੀਕ ਹੋਵੇਗੀ ਮੈ ਭੰਗੜਾ ਔਰਬੈਕਸ ਸ਼ੁਰੂ ਕੀਤਾ ਤੇ ਕਈ ਦਿਨਾਂ ਤੱਕ ਹਰ ਰੋਜ਼ ਰੂਟੀਨ ਦੇ ਨਾਲ ਭੰਗੜਾ ਕਰਦੀ ਰਹੀ ਤੇ ਅਜੇ ਤੱਕ ਵੀ ਕਰਦੀ ਹਾਂ ਪਰ ਹੁਣ ਮੇਰੀ ਸਿਹਤ ਵਿੱਚ ਕਾਫੀ ਸੁਧਾਰ ਹੋ ਗਿਆ ਹੈ ਮੈਨੂੰ ਆਪਣੇ ਤੁਰਨ ਫਿਰਨ ਵਿੱਚ ਕੋਈ ਤੰਗੀ ਨਹੀਂ ਹੁੰਦੀ ਭੰਗੜਾ ਇੱਕ ਐਸੀ ਚੀਜ਼ ਹੈ ਜਿਸ ਦੇ ਨਾਲ ਤੁਸੀਂ ਜਦੋਂ ਕਰਦੇ ਹੋ ਹਰ ਇੱਕ ਅੰਗ ਦੀ ਐਕਸਰਸਾਈਜ਼ ਹੁੰਦੀ ਹੈ ਭੰਗੜੇ ਨਾਲ ਸਿਹਤ ਵੀ ਠੀਕ ਹੁੰਦੀ ਹੈ ਮੈਂ ਹਰ ਇੱਕ ਨੂੰ ਇਹੀ ਸਲਾਹ ਦਿੰਦੀ ਹਾਂ ਕਿ ਜਿਸ ਤਰ੍ਹਾਂ ਮੈਂ ਭੰਗੜੇ ਨਾਲ ਆਪਣੀ ਸਿਹਤ ਠੀਕ ਕੀਤੀ ਹੈ ਤੁਸੀਂ ਵੀ ਇਦਾਂ ਹੀ ਕਰੋ ਕਿਉਂਕਿ ਦਵਾਈਆਂ ਖਾ ਕੇ ਸਿਹਤ ਠੀਕ ਨਹੀਂ ਹੁੰਦੀ ਭੰਗੜੇ ਨਾਲ ਹਰ ਅੰਗ ਬਾਵਾਂ ਲੱਤਾਂ ਹਰ ਇੱਕ ਚੀਜ਼ ਦੀ ਐਕਸਰਸਾਈਜ਼ ਹੁੰਦੀ ਹੈ ਨੱਚਣਾ ਟੱਪਣਾ ਡਾਂਸ ਕਰਨ ਦਾ ਜਿਸ ਨੂੰ ਸ਼ੌਂਕ ਹੋਵੇ ਉਹ ਭੰਗੜਾ ਆਸਾਨੀ ਨਾਲ ਕਰ ਸਕਦਾ ਹੈ ਜੇ ਤੁਸੀਂ ਭੰਗੜੇ ਨੂੰ ਇੱਕ ਤਰੀਕੇ ਨਾਲ ਐਕਸਰਸਾਈਜ਼ ਦੇ ਹਿਸਾਬ ਨਾਲ ਲਓਗੇ ਤਾਂ ਤੁਹਾਨੂੰ ਕੋਈ ਪਰੇਸ਼ਾਨੀ ਵੀ ਨਹੀਂ ਹੋਵੇਗੀ ਤੇ ਕੋਈ ਸ਼ਰਮ ਝਿਜਕ ਵੀ ਨਹੀਂ ਹੋਵੇਗੀ ਤੁਸੀਂ ਜਾਓ ਤਾਂ ਕਿਤੇ ਵੀ ਜਾ ਕੇ ਆਪਣਾ ਭੰਗੜਾ ਐਰੋਬਿਕਸ ਕਰ ਸਕਦੇ ਹੋ